ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅਸੀਂ ਨਾ ਦੋ ਤਰੀਕ ਨੂੰ ਅੰਮ੍ਰਿਤਸਰ ਗਏ ਬੜਾ ਸੋਹਣਾ ਸਫ਼ਰ ਹੋਇਆ ਵਧੀਆ ਬ ਸਾਨੂੰ ਬਸ ਮਿਲੀ ਉਹਦੇ ਵਿੱਚ ਬੜੀਆਂ ਹੀ ਸੀਟਾਂ ਸੋਹਣੀਆਂ ਸੀਗੀਆਂ ਵਿੱਚ ਵਾਟਰ ਕੂਲਰ ਸੀ ਪਾਣੀ ਵਾਲਾ ਸਾਡੇ ਨਾਲ ਫੈਮਲੀ ਸੀ ਸਾਡੀ ਵਧੀਆ ਜਮਾਏ ਹੋਈ ਵਧੀਆ ਬੈਗ ਰੱਖਣ ਨੂੰ ਜਗ੍ਹਾ ਸੀ ਵਧੀਆ ਪੈਰ ਰੱਖਣ ਨੂੰ ਜਗ੍ਹਾ ਸੀ ਸੀਟਾਂ ਵੀ ਬੜੀਆਂ ਪੋਲੀਆਂ ਸੀ ਬਾਕੀ ਜਿਹੜਾ ਡਰਾਈਵਰ ਸੀ ਉਹ ਵੀ ਬਹੁਤ ਵਧੀਆ ਸੀ ਵਧੀਆ ਹੱਸਦਾ ਖੇਡਦਾ ਲੈ ਕੇ ਗਿਆ ਉਹ ਤੋਂ ਬਾਅਦ ਅਸੀਂ ਜਾਂਦੇ ਰਹੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ 'ਚ ਉੱਥੇ ਜਾ ਕੇ ਮੱਥਾ ਟੇਕਿਆ ਇਸ਼ਨਾਨ ਪਾਣੀ ਕੀਤਾ ਲੰਗਰ ਪਾਣੀ ਖਾਧਾ ਉਹ ਤੋਂ ਬਾਅਦ ਦੇ ਨਾਲ ਬੱਚੇ ਸੀਗੇ ਫੈਮਲੀ ਸੀ ਅਤੇ ਘੁੰਮੇ ਫਿਰੇ ਅਸੀਂ ਵੈਸੇ ਉੱਥੋਂ ਦੀਆਂ ਕਹਿ ਦਿੰਦੇ ਆ ਜੁੱਤੀਆਂ ਬਹੁਤ ਸੋਹਣੀਆਂ ਕੱਪੜੇ ਬਹੁਤ ਸੋਹਣੇ ਆ ਗੋਲਡਨ ਗੇਟ ਦੇਖਿਆ ਜ਼ਿਲ੍ਹਿਆਂ ਵਾਲਾ ਬਾਗ ਦੇਖਿਆ ਉਹ ਤੋਂ ਬਾਅਦ ਬਾਜ਼ਾਰ 'ਚ ਗਏ ਘੁੰਮੇ ਫਿਰੇ ਚੂੜੀਆਂ ਲਈਆਂ ਪ੍ਰਸ਼ਾਦ ਲਿਆ ਜੋ ਚੀਜ਼ ਲੈਣੀ ਸੀ ਉਹ ਅਸੀਂ ਆਪਣੀ ਸਾਰੀ ਚੀਜ਼ ਲਈ ਵਧੀਆ ਅਸੀਂ ਰਾਤ ਰਹੇ ਅਗਲੇ ਦਿਨ ਜਦੋਂ ਅਸੀਂ ਆਏ ਹਾਂ ਉਦੇ ਵੀ ਸਾਡਾ ਬਹੁਤ ਵਧੀਆ ਸਫ਼ਰ ਰਿਹਾ ਬਹੁਤ ਵਧੀਆ ਬੱਸ ਮਿਲੀ ਬਹੁਤ ਵਧੀਆ ਡਰਾਈਵਰ ਸੀ ਬਹੁਤ ਵਧੀਆ ਸਵਾਰੀਆਂ ਸੀਗੀਆਂ ਵਿੱਚ ਵੈਸੇ ਹੱਸਦੇ ਖੇਡਦੇ ਅਸੀਂ ਆਏ ਹਾਂ ਬਹੁਤ ਵਧੀਆ ਬੈਗ ਰੱਖਣ ਨੂੰ ਜਗ੍ਹਾ ਸੀਗੀ ਬਹੁਤ ਵਧੀਆ ਪੈਰ ਰੱਖਣ ਨੂੰ ਜਗ੍ਹਾ ਸੀਗੀ ਭਾਵੇਂ ਦੀ ਲੰਮੀ ਸੀਟ ਕਰਕੇ ਬੱਚਾ ਸੌਂ ਵੀ ਜਾਵੇ ਜਨਾਨੀ ਵੀ ਸੌਂ ਸਕਦੀ ਸੀ ਨਾਲ ਵੀ ਇੰਨੀ ਵਧੀਆ ਸੀਟ ਸੀਗੀ ਪਰ ਇੰਨੀ ਕੋਈ ਸਾਨੂੰ ਔਖਿਆਈ ਜਿਹੀ ਨਹੀਂ ਆਈ ਗੀ ਅਸੀਂ ਵਧੀਆ ਗਏ ਹਾਂ ਆਪਣਾ ਆਰਾਮਦਾਰੀ ਨਾਲ ਗਏ ਹਾਂ ਅਰਾਮਦਾਰੀ ਨਾਲ ਅਸੀਂ ਅਸੀਂ ਆਏ ਹਾਂ ਆਪਣਾ ਉੱਥੇ ਵੀ ਅਸੀਂ ਆਪਣਾ ਘੁੰਮੇ ਫਿਰੇ ਹਾਂ ਘੁੰਮ ਫਿਰ ਕੇ ਅਸੀਂ ਜੁੱਤੀਆਂ ਵੀ ਲਈਆਂ ਸੂਟ ਵੀ ਲਏ ਪ੍ਰਸ਼ਾਦ ਵੀ ਲਿਆ ਬਾਬਾ ਜੀ ਦੇ ਵਧੀਆ ਦਰਸ਼ਨ ਕਰਕੇ ਆਏ ਸਾਡੇ ਬੱਚਿਆਂ ਨੇ ਵੀ ਬਹੁਤ ਵਧੀਆ ਦਰਸ਼ਨ ਕੀਤੇ ਬਹੁਤ ਵਧੀਆ ਵੈਸੇ ਮਨ ਬਹੁਤ ਵਧੀਆ ਖੁਸ਼ ਹੋਇਆ ਸਾਡਾ ਜਾ ਕੇ ਉੱਥੇ ਬਹੁਤ ਵਧੀਆ ਸਾਡਾ ਜੀਅ ਲੱਗਿਆ ਦੂਜੇ ਤੀਜੇ ਦਿਨ ਅਸੀਂ ਆਏ ਹਾਂ ਆ ਕੇ ਵੀ ਨਹੀਂ ਸਾਡਾ ਦਿਲ ਲੱਗਿਆ ਕਿਉਂਕਿ ਉੱਥੇ ਬਹੁਤ ਵਧੀਆ ਜਗ੍ਹਾ ਸੀਗੀ ਦੇਖਣ ਨੂੰ ਘੁੰਮਣ ਫਿਰਨ ਨੂੰ ਪਰ ਇੱਥੇ ਆ ਕੇ ਸਾਡਾ ਜੀਅ ਬਹੁਤ ਘੱਟ ਲੱਗਿਆ ਹੋਰ ਅਸੀਂ ਸਮਾਨ ਲੈ ਕੇ ਆਏ ਉੱਥੋਂ